ਸਤਿ ਸ਼੍ਰੀ ਅਕਾਲ ਸਰ ਮੈਂ ਆਪ ਦੀ ਵੈੱਬਸਾਈਟ ਤੋਂ ਤਕਰੀਬਨ ਤਿੰਨ ਜੂਨ ਦੇ ਸ਼ਾਮ ਪੰਜ ਵਜੇ ਓਡਰ ਕੀਤਾ ਸੀ ਜੋ ਕਿ ਇੱਕ ਕੈਜ਼ੂਅਲ ਸੂਜ਼ ਦਾ ਓਡਰ ਸੀ ਅਤੇ ਉਹ ਮੈਨੂੰ ਹਫਤੇ ਵਿੱਚ ਜਾਣੀ ਕਿ ਕਹਿ ਸਕਦੇ ਹਾਂ ਕਿ ਦਸ ਜੂਨ ਨੂੰ ਪ੍ਰਾਪਤ ਹੋ ਹੋ ਗਿਆ ਸੀ ਪਰ ਪਰੰਤੂ ਜਦੋਂ ਮੈਂ ਓਡਰ ਖੋਲ੍ਹ ਕੇ ਦੇਖਿਆ ਤਾਂ ਵਿੱਚੋਂ ਸਪੋਰਟਸ ਬੂਟ ਨਿਕਲੇ ਇਹ ਗੱਲ ਦੇਖ ਕੇ ਮੈਂ ਬੜਾ ਹੀ ਹੈਰਾਨ ਹੋਇਆ ਕਿ ਮੇਰੇ ਪੈਸਿਆਂ ਦਾ ਨੁਕਸਾਨ ਵੀ ਹੋਇਆ ਹੈ ਅਤੇ ਮੈਨੂੰ ਜੋ ਚੀਜ਼ ਮਿਲਣੀ ਚਾਹੀਦੀ ਸੀ ਉਹ ਵੀ ਨਹੀਂ ਮਿਲੀ ਇਸ ਤੋਂ ਇਲਾਵਾ ਮੈਂ ਉਸ ਹੀ ਸਮੇਂ ਇਸ ਓਡਰ ਨੂੰ ਕੈਂਸਲ ਕਰ ਦਿੱਤਾ ਪਰੰਤੂ ਓਡਰ ਕੈਂਸਲ ਕਰਨ ਤੋਂ ਬਾਅਦ ਵੀ ਤਕਰੀਬਨ ਇੱਕ ਮਹੀਨਾ ਬੀਤ ਚੁੱਕਿਆ ਹੈ ਮੇਰੇ ਪੈਸੇ ਫਿਰ ਵੀ ਰੀਫੰਡ ਨਹੀਂ ਹੋਏ ਮੈਂ ਆਪ ਜੀ ਅੱਗੇ ਬੇਨਤੀ ਕਰਦਾ ਕਰਨਾ ਚਾਹੁੰਦਾ ਹਾਂ ਕਿ ਮੇਰੀ ਐਪਲੀਕੇਸ਼ਨ ਨੂੰ ਦ ਦੇਖਿਆ ਜਾਵੇ ਤਾਂ ਕਿ ਮੈਨੂੰ ਰੀਫੰਡ ਜਲਦੀ ਤੋਂ ਜਲਦੀ ਮਿਲ ਸਕੇ